ਮਿਤੀ ਚੌਦ੍ਹਾਂ ਫਰਵਰੀ ਦੋ ਹਜ਼ਾਰ ਪੱਚੀ ਮੈਂ ਕੱਲ੍ਹ ਹੀ ਆਪਣੇ ਆਧਾਰ ਕਾਰਡ ਵਿੱਚ ਪਤਾ ਬਦਲਣ ਲਈ ਇੱਕ ਬੇਨਤੀ ਲਿਖੀ ਹੈ ਮੈਨੂੰ ਆਪਣੇ ਆਧਾਰ ਕਾਰਡ 'ਤੇ ਆਪਣਾ ਨਵਾਂ ਪਤਾ ਅਪਡੇਟ ਕਰਵਾਉਣਾ ਹੈ ਮੇਰਾ ਆਧਾਰ ਕਾਰਡ ਨੰਬਰ ਨੌਂ ਪੰਜ ਚਾਰ ਅੱਠ ਇੱਕ ਤਿੰਨ ਇੱਕ ਨੌਂ ਦੋ ਸੱਤ ਛੇ ਪੰਜ ਹੈ ਮੇਰਾ ਪੁਰਾਣਾ ਪਤਾ ਸੀ ਮੁਹੱਲਾ ਅਜੀਤ ਗਲੀ ਪੰਜ ਮੋਤੀ ਬਾਗ ਕਪੂਰਥਲਾ ਸ਼ਹਿਰ ਕਪੂਰਥਲਾ ਜ਼ਿਲ੍ਹਾ ਪੰਜਾਬ ਇੱਕ ਚਾਰ ਚਾਰ ਛੇ ਜ਼ੀਰੋ ਇੱਕ ਅਤੇ ਮੇਰਾ ਨਵਾਂ ਪਤਾ ਹੈ ਹਾਏ ਲਾਈਵ ਕੋਲੋਨੀ ਅਪਾਰਟਮੈਂਟ ਨੰਬਰ ਚੌਦ੍ਹਾਂ ਕਪੂਰਥਲਾ ਸ਼ਹਿਰ ਕਪੂਰਥਲਾ ਜ਼ਿਲ੍ਹਾ ਪੰਜਾਬ ਇੱਕ ਚਾਰ ਚਾਰ ਛੇ ਜ਼ੀਰੋ ਇੱਕ ਮੈਂ ਆਪਣੇ ਨਵੇਂ ਪਤੇ ਦੇ ਸਬੂਤ ਵਜੋਂ ਆਪਣੇ ਬਿਜਲੀ ਪਾਣੀ ਆਦਿ ਦਾ ਬਿਲ ਲੈ ਕੇ ਜਾਵਾਂਗਾ ਅਤੇ ਰੈਂਟ ਐਗਰੀਮੈਂਟ ਦੀ ਕਾਪੀ ਵੀ ਲੈ ਕੇ ਜਾਵਾਂਗਾ ਅਤੇ ਪਾਸਪੋਰਟ ਅਤੇ ਵੋਟਰ ਆਈਡੀ ਦੀ ਲੋੜ ਪਵੇ ਉਹ ਵੀ ਨਾਲ ਰੱਖ ਲਵਾਂਗਾ ਮੈਂ ਸਮਝਦਾ ਹਾਂ ਕਿ ਸੇਵਾ ਕੇਂਦਰ ਦੇ ਵਿੱਚ ਸਹੀ ਔਰ ਅਸਲੀ ਡਾਕੂਮੈਂਟਸ ਔਰ ਦਸਤਾਵੇਜਾਂ ਦੀ ਲੋੜ ਪੈਂਦੀ ਹੈ ਅਤੇ ਮੈਂ ਉੱਥੇ ਜਾ ਕੇ ਇੱਥੋਂ ਦੀ ਫੀਸ ਦਾ ਵੀ ਪੁੱਛ ਲਵਾਂਗਾ ਤਾਂ ਕਿ ਮੇਰਾ ਆਧਾਰ ਅਪਡੇਟ ਹੋ ਜਾਵੇ